ਜੇ ਦੇਖੀ ਜਾਏ ਗੁਰਦਾਸਪੁਰ ਜ਼ਿਲ੍ਹੇ ਦੀ ਤਾਂ ਮੌਸਮ ਦਾ ਇੰਨਾਂ ਅਸਰ ਕੋਈ ਨਹੀਂ ਪੈਂਦਾ ਕਿ ਗਰਮੀ ਅਤੇ ਸਰਦੀ ਦੇ ਹਿਸਾਬ ਨਾਲ ਸੈਲਾਨੀਆਂ 'ਤੇ ਉਨਾਂ ਅਸਰ ਪਵੇ ਪਰ ਜੇ ਤਾਂ ਵੀ ਤੁਸੀਂ ਚਾਹੁੰਦੇ ਹੋ ਕਿ ਕਿਸੇ ਥਾਂ ਦਾ ਤੁਸੀਂ ਪੂਰਾ ਲੁਤਫ ਉਠਾਉਣਾ ਚਾਹੁੰਦੇ ਹੋ ਅਤੇ ਉੱਥੇ ਦੀ ਹਰ ਇੱਕ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਘੁੰਮਣਾ ਫਿਰਨਾ ਚਾਹੁੰਦੇ ਆ ਤਾਂ ਮੈਂ ਇੰਨਾਂ ਹੀ ਕਵਾਂਗਾ ਕਿ ਜਦੋਂ ਅਪ੍ਰੈਲ ਜਾਂ ਫਿਰ ਸਤੰਬਰ ਨਾ ਜਿੱਥੇ ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਸਰਦੀ ਅਤੇ ਨਾ ਜ਼ਿਆਦਾ ਵਰ ਵਰਖਾ ਦਾ ਮੌਸਮ ਹੁੰਦਾ ਉਦੋਂ ਆਉਣਾ ਵਧੀਆ ਹੁੰਦਾ ਹੈ ਕਿਉਂਕਿ ਉਦੋਂ ਨਾ ਬੰਦੇ ਨੂੰ ਜ਼ਿਆਦਾ ਕੱਪੜਿਆਂ ਦੀ ਟੈਂਸ਼ਨ ਹੁੰਦੀ ਹੈ ਨਾ ਹੀ ਟੈਂਸ਼ਨ ਹੁੰਦੀ ਹੈ ਕਿ ਬੰਦੇ ਨੇ ਕਿੱਥੇ ਰੁਕਣਾ ਜਾਂ ਕਿੱਥੇ ਬਹਿਣਾ ਹੈ ਉਸ ਮੌਕੇ ਬੰਦਾ ਖੁੱਲ੍ਹ ਕੇ ਕਿਸੇ ਵੀ ਜਗ੍ਹਾ ਨੂੰ ਘੁੰਮ ਸਕਦਾ ਹੈ ਅਤੇ ਇੱਥੇ ਜਿਹੜੀ ਜਗ੍ਹਾਵਾਂ ਹਨ ਉਹ ਵੀ ਉਸੇ ਥਾਂ 'ਤੇ ਘੁੰਮਣ ਲਈ ਵਧੀਆ ਹਨ ਇੱਥੇ ਜੇ ਘੁੰਮਣਾ ਹੋਏ ਤਾਂ ਤਿਉਹਾਰਾਂ ਦੇ ਹਿਸਾਬ ਨਾਲ ਘੁੰਮਣਾ ਹੋਏ ਅਤੇ ਇੱਕ ਜਿਹੜਾ ਵਿਸਾਖੀ ਦਾ ਮੇਲਾ ਜਿਹੜਾ ਕਿ ਅਪ੍ਰੈਲ ਦੇ ਵਿੱਚ ਆਉਂਦਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਦੂਸਰਾ ਧਰਮ ਤਿਆੜੇ ਦਾ ਮੇਲਾ ਇਹ ਕਿ ਹੁੰਦਾ ਜੂਨ ਅਤੇ ਜੁਲਾਈ ਵਿੱਚ ਮਨਾਇਆ ਜਾਂਦਾ ਇੱਥੇ ਦੋ ਤੋਂ ਤਿੰਨ ਦਿਨ ਦਾ ਮੇਲਾ ਲੱਗਦਾ ਅਤੇ ਮੇਲੇ ਵਿੱਚ ਘੁੰਮਣ ਦਾ ਬਹੁਤ ਆਨੰਦ ਆਉਂਦਾ ਹੈ ਅਤੇ ਤੀਸਰਾ ਨਰਾਤੇ ਚੈਤਰ ਦੇ ਨਰਾਤੇ ਜਿਹੜੇ ਹੁੰਦੇ ਹਨ ਉਹਨਾਂ ਵਿੱਚ ਇੱਥੇ ਰਾਮਲੀਲਾ ਹੁੰਦੀ ਹੈ ਜੋ ਕਿ ਨੌ ਦਿਨ ਤੱਕ ਹਰ ਰਾਤ ਨੂੰ ਹੁੰਦੀ ਹੈ ਅਤੇ ਪਿੰਡ ਦੇ ਲੋਕ ਉਹ 'ਚ ਪਾਤਰ ਬਣ ਬਣ ਕੇ ਰਮਾਇਣ ਨੂੰ ਦਰਸ਼ਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਵਿੱਚ ਲੋਕਾਂ ਨੂੰ ਬਹੁਤ ਹੀ ਮਨੋਰੰਜਨ ਆਉਂਦਾ ਹੈ ਅਤੇ ਜੇ ਕੋਈ ਬਾਹਰੋਂ ਆਉਂਦਾ ਤਾਂ ਉਸਦੇ ਲਈ ਇਹ ਚੀਜ਼ ਬਹੁਤ ਹੀ ਵਧੀਆ ਦਰਸ਼ਨੀ ਹੁੰਦੀ ਹੈ ਅਤੇ ਇੱਥੇ ਆਮ ਤੌਰ 'ਤੇ ਜਿਹੜਾ ਹੈ ਗੁਰਦੁਆਰਾ ਗੁਰੂਪੁਰਬ ਜਿਹੜਾ ਹੁੰਦਾ ਉਹ ਵੀ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਪੰਜਾਬ ਸਟੇਟ ਜਿਹੜਾ ਹੈ ਸਿੱਖਾਂ ਦੇ ਬਹੁਤ ਨੇੜੇ ਮੰਨਿਆ ਜਾਂਦਾ ਹੈ ਅਤੇ ਸਿੱਖਾਂ ਦੇ ਹਿਸਾਬ ਨਾਲ ਇੱਥੇ ਬਹੁਤ ਚੀਜ਼ਾਂ ਬਹੁਤ ਤਿਉਹਾਰ ਹਨ ਉਨਦੇ ਵਿੱਚੋਂ ਇੱਕ ਮਹੱਤਵਪੂਰਨ ਤਿਉਹਾਰ ਜਿਹੜਾ ਹੈ ਹੋਲਾ ਮਹੱਲਾ ਵੀ ਹੁੰਦਾ ਹੈ ਅਤੇ ਨਵੇਂ ਸਾਲ 'ਤੇ ਵੀ ਗੁਰਦੁਆਰਾ ਹਰਿਮੰਦਰ ਸਾਹਿਬ ਵਿੱਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇੱਥੇ ਆਉਣ ਦਾ ਸਾਰਿਆਂ ਨਾਲੋਂ ਵਧੀਆ ਮੌਸਮ ਜਿਹੜਾ ਹੈ ਉਹ ਗਰਮੀ ਸਰਦੀ ਕਿਸੇ ਵੀ ਮੌਸਮ ਆਉ ਇੱਥੇ ਇਹੋ ਜਿਹੀ ਜਗ੍ਹਾ ਘੁੰਮਣ ਲਈ ਹਨ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਹਰ ਇੱਕ ਸਥਾਨ ਨੂੰ ਬਹੁਤ ਦਰਸ਼ਨੀ ਤਰੀਕੇ ਨਾਲ ਘੁੰਮ ਸਕਦੇ ਹੋ